ਮਨ ਪਸੰਦ ਲੇਖਕ ਵਜੋਂ ਮੈਨੂੰ ਬੀਬੀ ਇੰਦਰਜੀਤ ਕੌਰ ਜੀ ਬਹੁਤ ਪਸੰਦ ਹਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਿਤਾਬਾਂ ਲਿਖੀਆਂ ਹਨ ਅਤੇ ਉਹਨਾਂ ਦੀਆਂ ਕਿਤਾਬਾਂ ਹਰ ਇੱਕ ਵਿਸ਼ੇ 'ਤੇ ਹਨ ਜਿਵੇਂ ਕਿ ਵਾਤਾਵਰਣ ਬਾਰੇ ਲਿਖਿਆ ਸਾਡੇ ਜ਼ਿੰਦਗੀ ਜੀਣ ਬਾਰੇ ਲਿਖਿਆ ਜੀਣ ਦੇ ਢੰਗ ਸਿਖਾਏ ਗਏ ਸਾਡੀ ਸਿਹਤ ਬਾਰੇ ਬਹੁਤ ਕੁਛ ਉਹਨਾਂ ਨੇ ਲਿਖਿਆ ਔਰ ਉਹਨਾਂ ਦੀਆਂ ਜਿਹੜੀਆਂ ਮੇਨ ਕਿਤਾਬਾਂ ਮੈਨੂੰ ਪਸੰਦ ਹਨ ਭਗਤ ਪੂਰਨ ਸਿੰਘ ਜੀ ਬਾਰੇ ਉਹਨਾਂ ਦੀ ਜੀਵਨ ਸ਼ੈਲੀ ਬਾਰੇ ਉਨ੍ਹਾਂ ਨੇ ਬਹੁਤ ਚਾਨਣਾ ਪਾਇਆ ਹੈ ਔਰ ਉਸ ਚਾਨਣੇ ਦੇ ਵਿੱਚ ਉਨ੍ਹਾਂ ਨੇ ਸਾਨੂੰ ਇੱਕ ਜ਼ਿੰਦਗੀ ਜੀਣ ਦਾ ਢੰਗ ਸਿਖਾਇਆ ਗਿਆ ਹੈ ਕਿ ਇੱਕ ਸਰਬ ਗੁਣ ਸੰਪੰਨ ਵਿਅਕਤੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਭਗਤ ਪੂਰਨ ਸਿੰਘ ਜੀ ਸਨ ਜਿਨ੍ਹਾਂ ਬਾਰੇ ਉਨ੍ਹਾਂ ਨੇ ਸਾਨੂੰ ਦੱਸਿਆ ਹੈ ਜਿੱਥੋਂ ਤੱਕ ਗੱਲ ਰਹੀ ਇੱਕ ਲੇਖਕ ਬਾਰੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਉਨ੍ਹਾਂ ਨੇ ਸਾਨੂੰ ਇੱਕ ਜੀਵਨ ਸ਼ੈਲੀ ਵਿੱਚ ਜੀਣ ਦਾ ਢੰਗ ਬਾਰੇ ਦੱਸਿਆ ਹੈ ਅਤੇ ਬੀਬੀ ਇੰਦਰਜੀਤ ਕੌਰ ਨੇ ਵਾਤਾਵਰਣ ਨੂੰ ਕਿਵੇਂ ਸ਼ੁੱਧ ਰੱਖਣਾ ਸਰੀਰਕ ਪੱਖੋਂ ਆਪਣਾ ਵਿਕਾਸ ਕਿਵੇਂ ਕਰਨਾ ਅਤੇ ਸਾਨੂੰ ਜ਼ਿੰਦਗੀ ਜੀਣ ਦੇ ਜੀਵਨ ਸ਼ੈਲੀ ਬਾਰੇ ਦੱਸਣਾ ਇਹ ਮੈਨੂੰ ਬਹੁਤ ਵਧੀਆ ਗੱਲਾਂ ਉਨ੍ਹਾਂ ਦੀਆਂ ਲੱਗੀਆਂ ਹਨ ਸਤਿ ਸ਼੍ਰੀ ਆਕਾਲ ਜੀ